ਮੈਂ ਕਿਸੇ ਨੌਜਵਾਨ ਨੂੰ ਤਕਲਾਈ ਮੈਂ ਦੇ ਦੇ ਘੋੜੇ ਦੀ ਸਵਾਰੀ ਸਿਖਾਉਣਾ ਚਾਹੁੰਦਾ ਹਾਂ ਘੋੜੇ ਦੀ ਸਵਾਰੀ ਹੋਣ ਲਈ ਇਸ ਤਰ੍ਹਾਂ ਸਿਖਾਵਾਂਗਾ ਜੋ ਕਿ ਪੂਰੀ ਟਰੇਨਿੰਗ ਦੇ ਦਾਂਗਾ ਜੋ ਕਿ ਟ੍ਰੇਨਿੰਗ ਟ੍ਰੇਨਿੰਗ ਵਿੱਚ ਇਸ ਤਰ੍ਹਾਂ ਹੁੰਦਾ ਹੈ ਜੋ ਕਿ ਘੋੜੇ 'ਤੇ ਪਹਿਲਾਂ ਵਧੀਆ ਗੁਣ ਦੱਸਣੇ ਪੈਂਦੇ ਹਨ ਇਹ ਗੁਣ ਮੈਂ ਦੱਸਣ ਜਾ ਰਿਹਾ ਹਾਂ ਜੋ ਕਿ ਘੋੜੇ ਨੂੰ ਚੰਗੀ ਤਰ੍ਹਾਂ ਪਿਆਰ ਨਾਲ ਰੱਖਣਾ ਪੈਂਦਾ ਹੈ ਜੋ ਕਿ ਘੋੜੇ ਨੂੰ ਖਾਣਾ ਪੀਣਾ ਟਾਈਮ 'ਤੇ ਦੇ ਕੇ ਪੁਚਕਾਰ ਕੇ ਜੋ ਵੀ ਆਪਣਾ ਉਸ ਹਿਸਾਬ ਨਾਲ ਰੱਖ ਕੇ ਫਿਰ ਉਸ ਨਾਲ ਪੈਰ ਰੱਖ ਕੇ ਸਵਾਰੀ ਉੱਪਰ ਬੈਲਟ ਲਗਾਮ ਪਾ ਕੇ ਲਗਾਮ ਫੜ ਕੇ ਹੌਲੀ ਹੌਲੀ ਪੁਚਕਾਰ ਕੇ ਸਲੋ ਸਪੀਟ 'ਤੇ ਚਲਾਵੇ ਫਿਰ ਉਹ ਹੌਲੀ ਹੌਲੀ ਵੱਧ ਸਪੀਡ 'ਤੇ ਬੈਲਨਸ ਬਣ ਜਾਵੇ ਫਿਰ ਉਸ ਹਿਸਾਬ ਨਾਲ ਸਪੀਟ ਵਧਾ ਦਿੱਤੀ ਜਾਵੇ ਜੋ ਕਿ ਘੋੜਾ ਵੀ ਯਾਨੀ ਕਿ ਹੁਣ ਉਹ ਵੀ ਡਰੇ ਨਾ ਘੋੜਾ ਵੀ ਅਤੇ ਪਿੱਛੇ ਜਿਹੜਾ ਬੈਠਿਆ ਹੋਵੇ ਉਹ ਵੀ ਡਰੇ ਨਾ ਜੋ ਕਿ ਲਗਾਮ ਪਾ ਕੇ ਆਰਾਮ ਨਾਲ ਪੁਚਕਾਰ ਕੇ ਇਸਨੂੰ ਚਲਾਵੇ ਜਦੋਂ ਚਲਾਉਣਾ ਹੋਵੇ ਤਾਂ ਇੱਧਰ ਰਾਈਟ ਸਾਈਡ ਮੋੜਨਾ ਹੋਵੇ ਜਾਂ ਲੇਫਟ ਮੋੜਨਾ ਹੋਵੇ ਤਾਂ ਲਗਾਮ ਖਿੱਚ ਸਕਦਾ ਹੈ ਕਿਉਂਕਿ ਜ਼ਿਆਦਾ ਖਿੱਚੋਂਗੇ ਤਾਂ ਰੁਕ ਜਾਏਗਾ ਘੋੜਾ ਢਿੱਲੀ ਛੱਡੋਂਗੇ ਤਾਂ ਜ਼ਿਆਦਾ ਦੌੜੇਗਾ ਹੌਲੀ ਹੌਲੀ ਜੋ ਵੀ ਹੈ ਸ ਇਸ ਤਰ੍ਹਾਂ ਅਸੀਂ ਸਿਖਾ ਦਿੰਦੇ ਹਾਂ ਜੋ ਕਿ ਟ੍ਰੇਨਿੰਗ ਲੈ ਸਕਦਾ ਹੈ ਅਸੀਂ ਸਾਡਾ ਕੰਮ ਹੀ ਇਹ ਹੈ ਘੋੜੇ ਦੀ ਸਵਾਰੀ ਸਿਖਾਉਣਾ ਜੋ ਕਿ ਘੋੜੇ ਤੋਂ ਡਰ ਦੂਰ ਕਰਨਾ ਇਨਸਾਨ ਦਾ ਕਿਉਂਕਿ ਸਾਫ਼ ਜਗ੍ਹਾ 'ਤੇ ਸਾਫ਼ ਜਗ੍ਹਾ 'ਤੇ ਸਿਖਾਉਣੀ ਚਾਹੀਦੀ ਹੈ ਜੋ ਕਿ ਘੋੜੇ ਵੀ ਡਰੇ ਨਾ ਇਸ ਲਈ ਘੋੜੇ ਦੀ ਸਵਾਰੀ ਅਸੀਂ ਸਿਖਾ ਦਿੰਦੇ ਹਾਂ ਜੋ ਵੀ ਸਿੱਖਣਾ ਚਾਹੁੰਦੇ ਹੈ ਸਿੱਖ ਸਕਦੇ ਹੈ ਸਾਡੇ ਕੋਲੋਂ